ਜੀ ਮੈਂ ਅਕਸਰ ਹੀ ਸਕੂਲ ਦੇ ਜਿਹੜੇ ਫੰਕਸ਼ਨ ਸਨ ਉਹਨਾ ਦੇ ਵਿੱਚ ਹਿੱਸਾ ਲੈਂਦਾ ਰਿਹਾ ਹਾਂ ਕਦੇ ਭੰਗੜਾ ਹੋ ਗਿਆ ਕਦੇ ਕੋਈ ਕਲਾ ਦਾ ਮੁਕਾਬਲਾ ਹੋ ਗਿਆ ਤੇ ਤਜਰਬਾ ਬਹੁਤ ਵਧੀਆ ਰਿਹਾ ਹੈ ਮੇਰੀ ਅੱਗੇ ਵੀ ਦੂਜਿਆਂ ਨੂੰ ਵੀ ਇਹੀ ਸਲਾਹ ਹੈ ਕਿ ਤੁਸੀਂ ਸਕੂਲ ਦੇ ਵਿੱਚ ਜਾਂ ਆਪਣੇ ਕਾਲਜ ਦੇ ਵਿੱਚ ਜਿਹੜੇ ਫੰਕਸ਼ਨ ਹਨ ਉਹਨਾਂ ਦੇ ਵਿੱਚ ਹਿੱਸਾ ਜਰੂਰ ਲਓ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਦੇ ਨਾਲ ਜੋ ਤੁਹਾਡਾ ਮਨੋਬਲ ਵੀ ਵੱਧਦਾ ਹੈ ਤੇ ਤੁਹਾਡੀਆਂ ਜਿਹੜੀਆਂ ਯਾਦਾਂ ਹਨ ਉਹ ਬਣਦੀਆਂ ਹਨ ਕਦੇ ਬੀਤੇ ਸਮੇਂ ਤੋਂ ਬਾਅਦ ਜਿਹੜੀਆਂ ਯਾਦਾਂ ਹੈ ਉਸ ਨੂੰ ਯਾਦ ਕਰਕੇ ਹੀ ਜਿਹੜਾ ਇਨਸਾਨ ਹੈ ਉਹ ਆਪਣੀ ਜਿੰਦਗੀ ਜਿਹੜੀ ਉਹ ਲੰਘਾ ਲੈਂਦਾ ਹੈ ਤਾਂ ਆਪਣੀ ਯਾਦਾਂ ਨੂੰ ਵੱਧ ਤੋਂ ਵੱਧ ਵਧਾਓ ਤੇ ਇਹਨਾਂ ਪ੍ਰੋਗਰਾਮ ਵਿੱਚ ਹਿੱਸੇ ਲੈਂਦੇ ਰਹੋ